ਪਸ਼ੂ ਪਾਲਣ ਵਾਸਤੇ ਪਸ਼ੂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਪਸ਼ੂ ਤੰਦਰੁਸਤ ਹੋਣਗੇ ਤਾਂ ਪਸ਼ੂ ਦੀ ਅਤੇ ਜਿਵੇਂ ਮੱਕੀ ਪਸ਼ੂਆਂ ਦੇ ਖਾਦ ਵਿੱਚ ਇੱਕ ਮੁੱਖ ਤੱਤ ਹੈ ਖਾਸ ਕਰਕੇ ਮੇਰੀ ਅਤੇ ਗਾਈਆਂ ਲਈ ਸੋਇਆ ਬੀਨ ਭੋਜਨ ਸੋਇਆ ਬੀਨ ਨੂੰ ਪਸ਼ੂ ਫੀਡ ਵਿੱਚ ਪ੍ਰੋਟੀਨ ਦੇ ਸੋਦੇ ਵਜੋਂ ਵਰਤਿਆ ਜਾਂਦਾ ਹੈ ਖਾਸ ਕਰਕੇ ਮੁੱਖ ਛੇ ਅਤੇ ਮੁਰਗੀਆਂ ਦੀ ਅਸਫਲਤਾ ਇਹ ਇੱਕ ਖਾਣਾ ਹੈ ਜੋ ਘੋੜਿਆਂ ਖੱਚਰਾਂ ਅਤੇ ਹੋਰ ਬੜੇ ਪਸ਼ੂਆਂ ਨੂੰ ਪਸੰਦ ਆਉਂਦਿਆਂ ਹੈ ਅਤੇ ਇਹ ਵਿਟਾਮਿਨ ਅਤੇ ਖਣਿਜਾਂ ਦਾ ਅੱਛਾ ਸਰੋਤ ਹੈ ਸਰੋਤ ਹੈ ਘਾਹ ਨੂੰ ਰਾਜ ਅਤੇ ਪਸ਼ੂਆਂ ਦੇ ਖੁਰਾਕ ਵਿੱਚ ਇੱਕ ਮੁੱਖ ਹਿੱਸਾ ਬਣਾਇਆ ਜਾਂਦਾ ਹੈ ਖਾਸ ਕਰਕੇ ਗਾਈਆਂ ਅਤੇ ਭੈਂਸਾਂ ਲਈ ਦਾਲਾਂ ਅਤੇ ਫਲ ਕੁਛ ਪਸ਼ੂਆਂ ਨੂੰ ਸਿਹਤਮੰਦ ਅਤੇ ਸੰਤੁਲਿਤ ਲਈ ਦਾਲਾਂ ਅਤੇ ਦਿੱਤੇ ਜਾਂਦੇ ਹਨ ਖਾਸ ਕਰਕੇ ਮੁਰਗੀਆਂ ਅਤੇ ਕੱਚੇ ਜਾਨਵਰਾਂ ਲਈ ਸਿਹਤਮੰਦ ਆਉਟਪੁੱਟ ਪ੍ਰਾਪਤ ਕਰਨ ਲਈ ਜਾਨਵਰਾਂ ਨੂੰ ਪ੍ਰੋਟੀਨ ਕਾਰਬੋਹਡਰੇਟ ਖਣਿਜ ਅਤੇ ਵਿਟਾਮਿਨ ਦੀ ਸਹੀ ਮਾਤਰਾ ਵਿੱਚ ਮਿਲਦੀਆਂ ਨੇ ਖੁਰਾਕ ਦਿੱਤੀ ਜਾਂਦੀ ਹੈ ਇਸ ਲਈ ਇਸ ਨਾਲ ਉਹਨਾਂ ਦੀ ਤੰਦਰੁਸਤੀ ਉਤਪਾਦਨ ਵੱਧਦੀ ਹੈ